ਬਾਈ ਜੀ ਮੇਰੀ ਪਲੱਸ ਟੂ ਕੰਪਲੀਟ ਹੋ ਗਈ ਆ ਵੀ ਹੁਣ ਮੈਂ ਆਈਲੈਟਸ ਕਰ ਲਈ ਵੀ ਫੋਰਨ ਜਾਣ ਤੁਸੀਂ ਕੋਈ ਵਾਲੀ ਰਾਏ ਦੋ ਨਹੀਂ ਬਾਈ ਮੈਂ ਵਿਆਹ ਨਹੀਂ ਕਰਵਾਉਣਾ ਗਾ ਫਿਰ ਤੁਹਾਨੂੰ ਪਤਾ ਵੀ ਵਿਆਹ ਕਰਵਾ ਕੇ ਤਾਂ ਵੀ ਮੈਂ ਕਿਸੇ ਲਈ ਜੇ ਮੈਂ ਵਿਆਹ ਕਰਵਾ ਕੇ ਜਾਊਂਗੀ ਤਾਂ ਮੈਂ ਤੁਹਾਨੂੰ ਥੋੜ੍ਹੀ ਪੈਸੇ ਭੇਜ ਸਕਦੀ ਮੈਂ ਤਾਂ ਉਹਨਾਂ ਨੂੰ ਹੀ ਭੇਜੂੰਗੀ ਫਿਰ ਮੇਰਾ ਜਾਏਦਾ ਕੀ ਫਾਇਦਾ ਹੋਇਆ ਬਾਈ ਫਿਰ ਮੈਂ ਬਾਅਦ ਜੇ ਮੈਂ ਬਾਹਰ ਜਾ ਵੜੀ ਦਾ ਫਿਰ ਮੈਂ ਤੁਹਾਨੂੰ ਵੀ ਬਾਹਰ ਸੱਦ ਲੂੰਗੀ ਵੀ ਆਪਣੇ ਘਰ ਦੀ ਸਾਰੀ ਗਰੀਬੀ ਚੱਕੀ ਜਾਊਗੀ ਵੀ ਜਿੰਨੇ ਵੀ ਪੈਸੇ ਹੋਣਗੇ ਵੀ ਮੈਂ ਤੁਹਾਨੂੰ ਇੱਧਰ ਹੀ ਭੇਜਦੀ ਰਹੂੰਗੀ ਬਾਈ ਫਿਰ ਮੈਂ ਤਾਂ ਵੀ ਬਾਹਰ ਹੀ ਜਾਣਾ ਗਾ ਤੁਹਾਨੂੰ ਪਤਾ ਵੀ ਇੱਧਰ ਦਾ ਆਪਣਾ ਕੁਛ ਬਣਦਾ ਹੀ ਨਹੀਂ ਗਾ ਨਾ ਇੱਧਰੋਂ ਕੋਈ ਨੌਕਰੀ ਵਗੈਰਾ ਮਿਲਦੀ ਆ ਨਾ ਕੋਈ ਜੋਬ ਵਗੈਰਾ ਮਿਲਦੀ ਹੈਗੀ ਹਾਂ ਬਈ ਹਾਂ ਬਈ ਉਹ ਤਾਂ ਹੈਗਾ ਗਾ ਉੱਧਰ ਜਾ ਕੇ ਤਾਂ ਵੀ ਨਾਲੇ ਜੋਬ ਦਾ ਮੇਰੀ ਪਰ ਇੱਕ ਤਾ ਕੰਮ ਤਾਂ ਕਰਨਾ ਹੀ ਪੈਂਦਾ ਗਾ ਅਤੇ ਫਿਰ ਮੈਂ ਜਦੋਂ ਜਾ ਵੜੀ ਫਿਰ ਮੈਂ ਤੁਹਾਨੂੰ ਵੀ ਸੱਦ ਲੂਗੀ ਆਪੇ ਪਿੱਛੇ ਮੰਮੀ ਡੈਡੀ ਨੂੰ ਸੱਦ ਲੂਗੀ ਹਾਂ ਬਈ ਜੇ ਮੈਂ ਵਿਆਹ ਕਰਵਾ ਕੇ ਗਈ ਫਿਰ ਤੁਹਾਨੂੰ ਪਤਾ ਵੀ ਜਿਹ ਨਾਲ ਵਿਆਹ ਕਰਵਾ ਕੇ ਉਹ ਫਿਰ ਕੋਈ ਨਹੀਂ ਐਂ ਕਿਸੇ ਨੂੰ ਪੈਸੇ ਭੇਜਣ ਦਿੰਦਾ ਫਿਰ ਆਪਣੇ ਉਹੀ ਤਾਂ ਆਪਣੇ ਹਾਲ ਫੇਰ ਰਹਿਣਗੇ ਹਾਂ ਵੀ ਫਿਰ ਘਰ ਗੱਲ ਕਰ ਵੀ ਆਪਣੇ ਮੰਮੀ ਡੈਡੀ ਨਾਲ ਵੀ ਆਪਾਂ ਹੁਣ ਅੱਗੇ ਕੀ ਕਰੀਏ ਹਾਂ